ਖੇਡਾਂ ਦਾ ਹਰ ਇੱਕ ਦੇ ਜੀਵਨ 'ਤੇ ਬਹੁਤ ਯੋਗਦਾਨ ਹੁੰਦਾ ਹੈ ਜਿਵੇਂ ਕਿ ਖੇਡਾਂ ਸਾਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਦੀਆਂ ਹਨ ਖੇਡਾਂ ਚਾਹੇ ਅਸੀਂ ਕੋਈ ਮੈਡਲ ਲੈਣ ਲਈ ਖੇਡੀਏ ਜਾਂ ਆਪਣੀ ਖੁਸ਼ੀ ਲਈ ਖੇਡੀਏ ਉਹ ਸਾਨੂੰ ਤੰਦਰੁਸਤੀ ਤਾਂ ਦੇ ਹੀ ਦਿੰਦੀਆਂ ਹਨ ਇਸ ਤਰ੍ਹਾਂ ਉਹ ਸਾਡਾ ਜਿਹੜਾ ਗੁਣਵੱਤਾ ਜਦੋਂ ਸਾਡਾ ਸਰੀਰ ਤੰਦਰੁਸਤ ਹੁੰਦਾ ਆ ਉਦੋਂ ਅਸੀਂ ਕੋਈ ਵੀ ਕੰਮ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਇਸ ਤਰ੍ਹਾਂ ਸਾਡੀ ਗੁਣਵੱਤਾ 'ਤੇ ਵੀ ਪੋਜੀਟਿਵ ਪਰਭਾਸ ਪ੍ਰਭਾਵ ਜਿਹੜਾ ਉਹ ਪਾ ਸਕਦੀਆਂ ਹਨ ਜਿਹੜੀਆਂ ਖੇਡਾਂ ਖੇਡਾਂ ਤੁਸੀਂ ਦੇਖੋ ਕਿ ਜਿਵੇਂ ਕੋਈ ਬੱਚਾ ਹੈ ਜਿਹੜਾ ਆਊਟਡੋਰ ਗੇਮਾਂ ਖੇਡਦਾ ਹੈ ਫੁੱਟਬਾਲ ਖੇਡਦਾ ਹੈ ਕਬੱਡੀ ਖੇਡਦਾ ਹੈ ਉਹ ਬੱਚਾ ਜਿਹੜਾ ਆ ਉਹ ਸਟਰੋਂਗ ਹੁੰਦਾ ਸਰੀਰਕ ਤੌਰ 'ਤੇ ਵੀ ਅਤੇ ਮਾਨਸਿਕ ਤੌਰ 'ਤੇ ਵੀ ਅਤੇ ਜਿਹੜੇ ਬੱਚੇ ਫੋਨ ਦੀਆਂ ਗੇਮਾਂ 'ਚ ਲੱਗ ਜਾਂਦੇ ਨੇ ਉਹ ਜਿਹੜਾ ਆ ਉਹ ਮਾਨਸਿਕ ਤੌਰ ਅਤੇ ਹੌਲੀ ਹੌਲੀ ਵੀਕ ਹੋਈ ਜਾਂਦੇ ਆ ਜਦ ਕਿ ਜਿਹੜਾ ਸਰੀਰਿਕ ਖੇਡਾਂ ਖੇਡਣ ਵਾਲੇ ਬੱਚੇ ਆ ਉਹ ਹੌਲੀ ਹੌਲੀ ਤੰਦਰੁਸਤ ਹੋਈ ਜਾਂਦੇ ਤਾਕਤਵਰ ਹੋਈ ਜਾਂਦੇ ਉਹਨਾਂ ਦਾ ਸਰੀਰ ਜਿਹੜਾ ਵਾ ਉਹਨਾਂ ਦੀ ਇੱਕ ਐਸਿਟ ਬਣ ਜਾਂਦਾ ਸਰੀਰ ਹੀ ਉਹਨਾਂ ਦੀ ਇੱਕ ਐਸਿਟ ਬਣ ਜਾਂਦਾ ਉਸ ਸਰੀਰਕ ਸਮਰੱਥਾ ਨਾਲ ਉਹ ਜਿਹੜਾ ਆ ਉਹਨਾਂ ਦੀ ਲਾਈਫ ਵੀ ਲੋਂਗ ਹੁੰਦੀ ਜਿਵੇਂ ਆਪਾਂ ਦੇਖਦੇ ਹਾਂ ਕਿ ਆਰਮੀ ਪਰਸਨਲ ਜਿਹੜੇ ਹੁੰਦੇ ਆ ਉਹ ਆਫਟਰ ਸਿਕਸਟੀ ਵੀ ਆਪਣਾ ਜਿਹੜਾ ਵਾ ਉਹ ਰੁਝਾਨ ਫਿਟਨੈਸ ਦਾ ਫਿਜੀਕਲ ਫਿਟਨੈਸ ਦਾ ਉਹ ਰੱਖਦੇ ਨੇ ਅਤੇ ਉਹਨਾਂ ਦੀ ਲਾਈਫ ਲੌਂਗ ਹੁੰਦੀ ਹੈ ਜਾਂ ਆਮ ਲੋਕਾਂ ਨਾਲੋਂ ਤਾਂ ਆਮ ਜਿਹੜਾ ਬੰਦਾ ਵਾ ਉਹ ਸੱਠ ਸਾਲ ਤੱਕ ਕੰਮ ਕਰਦਾ ਜਿਹਦਾ ਕਿ ਫਿਜੀਕਲ ਕੋਈ ਵਰਕ ਨਹੀਂ ਹੁੰਦਾ ਉਹ ਸੱਠ ਸਾਲ ਬਾਅਦ ਉਹ ਕਹਿੰਦਾ ਮੈਂ ਰਿਟਾਇਰ ਹੋ ਗਿਆ ਨਾ ਉਹ ਫਿਜੀਕਲ ਵਰਕ ਕਰਦਾ ਨਾ ਉਹ ਮੈਂਟਲ ਵਰਕ ਕਰਦਾ ਉਹ ਫਿਜੀਕਲੀ ਅਤੇ ਮੈਂਟਲੀ ਦੋਨਾਂ ਤਰੀਕੇ ਨਾਲ ਜਿਹੜਾ ਉਹ ਕਮਜ਼ੋਰ ਹੋ ਜਾਂਦਾ ਅਤੇ ਜਿਹੜੇ ਆਰਮੀ ਪਰਸਨਲ ਹੁੰਦੇ ਆ ਜਾਂ ਜਿਹੜੇ ਲੋਕ ਖੇਡਾਂ ਨਾਲ ਜੁੜੇ ਹੁੰਦੇ ਆ ਉਹ ਕਈ ਲੋਕ ਦੇ ਉਮ ਖੇਡਾਂ ਦਾ ਉਮਰ ਨਾ ਕੋਈ ਨਹੀਂ ਹੈ ਲੈਣਾ ਦੇਣਾ ਤੁਸੀਂ ਜਿਹੜੇ ਖੇਡਾਂ ਨੂੰ ਪਸੰਦ ਕਰਦੇ ਨੇ ਉਹ ਹਰ ਉਮਰ 'ਚ ਉਹ ਆਪਣਾ ਲੱਗੇ ਰਹਿੰਦੇ ਨੇ ਇੱਕ ਆਪਾਂ ਦੇਖਦੇ ਸਾਂ ਪਿੱਛੇ ਜੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਇੰਗਲੈਂਡ ਉਹ ਜਿਹੜੇ ਮੈਰਾਥਨ ਦੌੜਾਂ ਦੇ ਵਿੱਚ ਦੌੜਾਂ ਲਗਾਉਂਦੇ ਸੀ ਇੱਕ ਬਜ਼ੁਰਗ ਵੀ ਹੁੰਦੇ ਸੀ ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ ਉਹਨਾਂ ਦਾ ਉਹ ਵੀ ਬਾਹਰ ਬਾਹਰ ਦੇ ਜਿਹੜੇ ਇੰਗਲੈਂਡ ਦੇ ਵਿੱਚ ਹੀ ਸ਼ਾਇਦ ਸੀਗੇ ਉਹ ਵੀ ਮੈਰਾਥਨ ਦੇ ਵਿੱਚ ਚੈਰਿਟੀ ਕੌਜ਼ ਲਈ ਦੌੜਦੇ ਹੁੰਦੇ ਸੋ ਜਿਹਨਾਂ ਦਾ ਖੇਡਣਾ ਨਾਲ ਪਿਆਰ ਆ ਉਹਨਾਂ ਨੂੰ ਉਮਰ ਕੋਈ ਮਾਇਨੇ ਨਹੀਂ ਰੱਖਦੀ ਉਹ ਹਰ ਉਮਰ 'ਚ ਖੇਡਣਾ ਉਹਨਾਂ ਦਾ ਪਿਆਰ ਹੈ ਉਹ ਖੇਡਦੇ ਉਹ ਖੇਡ ਹੀ ਜੀਵਨ ਹੋ ਜਾਂਦਾ ਖੇਡ ਤੰਦਰੁਸਤੀ ਹੋ ਜਾਂਦੀ ਖੇਡ ਹੀ ਉਹਨਾਂ ਦਾ ਜਿਹੜਾ ਸਰੀਰ ਜਿਹੜਾ ਉਹ ਗੁਣਵੱਤਾ ਉਹਨਾਂ ਦੀ ਵੱਧ ਜਾਂਦੀ ਕੰਮ ਕਰਨ ਦੀ ਸਮਰੱਥਾ ਫਿਰ ਕਈ ਵਾਰੀ ਅਸੀਂ ਆਪਣਾ ਮੰਨ ਲਉ ਕੋਈ ਕੰਮ ਆ ਕਰਦੇ ਕਰਦੇ ਥੱਕ ਜਾਂਦੇ ਹਾਂ ਜੇ ਅਸੀਂ ਕੋਈ ਵਿੱਚ ਖੇਡ ਰੱਖੀ ਹੈ ਫਿਜੀਕਲ ਫਿਟਨੈਸ ਰੱਖੀ ਉਹ ਸਾਡੀ ਜਿਹੜੀ ਥਕਾਵਟ ਆ ਨਾ ਕੰਮ ਦੇ ਉੱਤੋਂ ਥਕਾਵਟ ਉਹ ਲਹਿ ਜਾਂਦੀ ਖੇਡਣ ਨਾਲ